ਮੌਜੂਦਾ ਦ੍ਰਿਸ਼ ਵਿੱਚ ਵਿਗਿਆਪਨ ਅਤੇ ਵਧੇਰੇ ਲੋਕਾਂ ਤੱਕ ਪਹੁੰਚਣ ਦਾ ਤਰੀਕਾ ਅੱਜ ਕੱਲ੍ਹ ਸੋਸ਼ਲ ਮੀਡੀਆ ਹੋ ਗਿਆ ਹੈ ਜੀ ਜਿਹਦੇ ਵਿੱਚ ਸੋਸ਼ਲ ਮੀਡੀਆ ਦੇ ਕੁਛ ਤਰੀਕੇ ਹਨ ਜਿਵੇਂ ਕਿ ਸੋਸ਼ਲ ਮੀਡੀਆ ਦੇ ਵਿੱਚ ਇੰਸਟਾਗ੍ਰਾਮ ਫੇਸਬੁੱਕ ਲਿੰਕਡਨ ਵਰਗੇ ਟਵੀਟਰ ਵਰਗੇ ਕੁਛ ਐਸੀਆਂ ਨੈਟਵਰਕਿੰਗ ਸਾਈਟਸ ਨੇ ਜਿਹਨਾਂ ਉੱਤੇ ਲੋਕ ਜ਼ਿਆਦਾ ਇਸ਼ਤਿਹਾਰ ਦੇਣਾ ਪਸੰਦ ਕਰਦੇ ਹਨ ਜਿਹਨਾਂ ਦੇ ਉੱਤੇ ਕੰਟੈਂਟ ਕ੍ਰੀਏਟ ਕਰਕੇ ਲੋਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਪਹੁੰਚਿਆ ਜਾਂਦਾ ਹੈ ਸੋ ਇਹਨਾਂ ਵਿੱਚੋਂ ਜਿਹੜਾ ਰਚਨਾਤਮਕ ਅਤੇ ਪ੍ਰਭਾਵਸ਼ਾਲੀ ਕੰਟੈਂਟ ਹੈ ਉਹ ਇੰਸਟਾਗ੍ਰਾਮ ਦੇ ਉੱਤੇ ਵਿਗਿਆਪਨ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਕੰਟੈਂਟ ਸੋਹਣੇ ਤਰੀਕੇ ਨਾਲ ਕ੍ਰੀਏਟ ਕਰਕੇ ਆਪਣੇ ਜਿਹੜੇ ਮੌਜੂਦਾ ਕਸਟਮਰ ਅਤੇ ਕੰਜਊਮਰ ਹਨ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਜ਼ਿਆਦਾ ਸੋਹਣੇ ਢੰਗ ਨਾਲ ਪੇਸ਼ ਕਰਕੇ ਪ੍ਰਭਾਵਸ਼ਾਲੀ ਬਣਾਇਆ ਜਾਂਦਾ ਹੈ ਅਤੇ ਉਹੀ ਮੈਨੂੰ ਵੀ ਰਚਨਾਤਮਕ ਲੱਗਿਆ ਜੀ